ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੰਮ੍ਰਿਤਸਰ ਵਿੱਚ ਵੈਸੇ ਤਾਂ ਬਹੁਤ ਸਾਰੇ ਸਕੂਲਜ਼ ਨੇ ਪਰ ਇੱਕ ਸਕੂਲ ਹੈਗਾ ਸਿਕਰੇਟ ਹਾਰਟ ਸੀਨੀਅਰ ਸੈਕੈਂਡਰੀ ਸਕੂਲ ਇਹ ਮਜੀਠਾ ਰੋਡ ਦੇ ਲਾਗੇ ਹੈ ਅਤੇ ਤੁਸੀਂ ਆਪਣੇ ਬੱਚੇ ਨੂੰ ਉੱਥੇ ਪਾ ਸਕਦੇ ਹੋ ਮੈਂ ਵੀ ਸੋਚਦੀ ਸੀ ਕਿ ਆਪਣੀ ਬੇਟੀ ਨੂੰ ਉੱਥੇ ਪਾਉਣਾ ਅਤੇ ਤੁਸੀਂ ਵਧੀਆ ਗੱਲ ਮੈਨੂੰ ਕੋਲ ਕਰ ਲਈ ਮੈਂ ਵੀ ਉੱਥੇ ਹੀ ਸੋਚ ਰਹੀ ਸੀ ਉੱਥੇ ਇੱਕ ਤਾਂ ਪੜ੍ਹਾਈ ਵੀ ਬਹੁਤ ਵਧੀਆ ਅਤੇ ਸਟੱਡੀ ਦੇ ਨਾਲ ਨਾਲ ਬੱਚਿਆਂ ਨੂੰ ਸਪੋਰਟਸ ਵਿੱਚ ਵੀ ਬਹੁਤ ਕੁਛ ਸਿਖਾਉਂਦੇ ਨੇ ਜਿਹਦੇ ਕਾਰਨ ਬੱਚਿਆਂ ਦੀ ਜਿਹੜੀ ਬੋਡੀ ਆ ਉਹ ਬਹੁਤ ਜ਼ਿਆਦਾ ਫਿੱਟ ਰਹਿੰਦੀ ਆ ਅਤੇ ਮੈਂ ਵੀ ਸੋਚ ਰਹੀ ਸੀ ਕਿ ਬੱਚਿਆਂ ਨੂੰ ਉੱਥੇ ਪਾ ਦੇਈਏ ਹਾ ਹਾਂਜੀ ਹਾਂਜੀ ਤੁਸੀਂ ਮੈਨੂੰ ਦੱਸ ਦਿਓ ਮੈਂ ਆਜੂਗੀ ਠੀਕ ਹੈ ਜੀ ਧੰਨਵਾਦ ਜੀ